ਹਾਂਜੀ ਹਰ ਇੱਕ ਕਿਸਾਨ ਦੇ ਲਈ ਵਾਢੀ ਦਾ ਤਿਉਹਾਰ ਇੱਕ ਹੀ ਹੁੰਦਾ ਹੈ ਅਤੇ ਉਹ ਹੁੰਦਾ ਹੈ ਵਿਸਾਖੀ ਵਿਸਾਖੀ ਹਰ ਇੱਕ ਕਿਸਾਨ ਹਰ ਇੱਕ ਮਜ਼ਦੂਰ ਜਿਸਦੇ ਆਪਣੇ ਖੇਤ ਹੁੰਦੇ ਹਨ ਉਹ ਬੜੇ ਚਾਅ ਅਤੇ ਰੀਝਾਂ ਨਾਲ ਮਨਾਉਂਦਾ ਹੈ ਕਿਉਂਕਿ ਕਿਸਾਨ ਨੇ ਆਪਣੀ ਫਸਲ ਉਗਾਈ ਹੁੰਦੀ ਹੈ ਅਤੇ ਉਹਨੂੰ ਪੁੱਤਾਂ ਵਾਂਗੂੰ ਪਾਲਿਆ ਹੁੰਦਾ ਹੈ ਅਤੇ ਉਹ ਬੜਾ ਹੀ ਖੁਸ਼ਹਾਲ ਹੁੰਦਾ ਹੈ ਉਦੋਂ ਕਿਉਂਕਿ ਵਿਸਾਖੀ ਦੇ ਲਾਗੇ ਜਾਗੇ ਕਣਕ ਸੁਨਹਿਰੀ ਰੰਗ ਦੀ ਹੋਈ ਹੁੰਦੀ ਹੈ ਅਤੇ ਹਰ ਕੋਈ ਆਪਣਾ ਉੱਦਣ ਬਹੁਤ ਖੁਸ਼ ਹੁੰਦਾ ਹੈ ਅਤੇ ਵਾਢੀ ਤੋਂ ਬਾਅਦ ਉਹ ਆਪਣੇ ਘਰਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ ਆੜ੍ਹਤੀਆਂ ਕੋਲੋਂ ਪੈਸੇ ਲੈ ਕੇ ਆਪਣਾ ਸਾਲ ਦਾ ਜੋ ਵੀ ਮੁਨਾਫਾ ਹੁੰਦਾ ਹੈ ਉਹਦੇ ਤੋਂ ਆਪਣਾ ਖੁਸ਼ਹਾਲ ਜੀਵਨ ਜਿਉਂਦੇ ਹਨ ਅਤੇ ਹਰ ਕੋਈ ਵਿਸਾਖੀ ਨੂੰ ਬੜੇ ਰੀਝ ਨਾਲ ਮਨਾਉਂਦਾ ਹੈ ਧੰਨਵਾਦ